ਜਦੋਂ ਮੇਰੇ ਕੋਲ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਭੋਜਨ ਦੇ ਵਿੱਚ ਚੌਲ ਬਣਾਉਂਦੀ ਹਾਂ ਚੌਲਾਂ ਨੂੰ ਕਈ ਤਰ੍ਹਾਂ ਨਾਲ ਬਣਾਇਆ ਜਾ ਸਕਦਾ ਹੈ ਚੌਲ ਨਮਕੀਨ ਵੀ ਬਣਾਏ ਜਾਂਦੇ ਨੇ ਚੌਲ ਮਿੱਠੇ ਵੀ ਬਣਾ ਹੋ ਸਕਦੇ ਨੇ ਮੈਂ ਇਹ ਚੀਜ਼ ਸਮੇਂ ਦੇ ਹਿਸਾਬ ਨਾਲ ਦੇਖਦੀ ਹਾਂ ਕਿ ਕਿਸ ਨੂੰ ਉਸ ਕਿਸ ਤਰ੍ਹਾਂ ਦੇ ਚੌਲ ਪਸੰਦ ਨੇ ਮੇਰੇ ਪਰਿਵਾਰ ਨੂੰ ਜਿਵੇਂ ਮੇਰੇ ਪਰਿਵਾਰ ਦਾ ਚੌਲ ਨਮਕੀਨ ਖਾਣ ਦਾ ਮਨ ਕਰਦਾ ਤਾਂ ਮੈਂ ਨਮਕੀਨ ਚੌਲ ਬਣਾ ਲੈਂਦੀ ਹਾਂ ਜੇਕਰ ਉਸਦਾ ਮੇਰੇ ਪਰਿਵਾਰ ਵਾਲਿਆਂ ਨੂੰ ਮਿੱਠੇ ਚੌਲ ਦੀ ਪਸੰਦ ਹੁੰਦੀ ਹੈ ਤਾਂ ਫਿਰ ਮੈਂ ਮਿੱਠੇ ਚੌਲਾਂ ਦੇ ਵਿੱਚ ਕ ਕਈ ਵਾਰੀ ਚੀਨੀ ਵਾਲੇ ਚੌਲ ਵੀ ਬਣਾ ਲਏ ਜਾਂਦੇ ਹਨ ਕਈ ਵਾਰੀ ਗੁੜ ਸ ਜਾਂ ਸ਼ੱਕਰ ਪਾ ਕੇ ਵੀ ਚੌਲ ਬਣਾ ਲਏ ਜਾਂਦੇ ਹਨ ਇਸ ਤਰ੍ਹਾਂ ਜਿਹੜੇ ਹੈਗੇ ਚੌਲਾਂ ਦੀ ਇੱਕ ਜਦੋਂ ਮੇਰੇ ਕੋਲ ਸਮਾਂ ਘੱਟ ਹੁੰਦਾ ਤਾਂ ਮੈਂ ਚੌਲ ਹੀ ਬਣਾਉਣਾ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਜੇਕਰ ਏ ਸਮਾਂ ਘੱਟ ਹੋਵੇ ਤਾਂ ਉਸ ਟਾਈਮ ਭੋਜਨ ਖਾਣ ਦਾ ਤਾਂ ਸਮਾਂ ਹੋਇਆ ਹੋਵੇ ਤਾਂ ਉਸ ਫਿਰ ਇਹ ਦੇਖਣਾ ਪੈਂਦਾ ਏ ਕਿ ਅਗਰ ਤਾਂ ਸਬਜ਼ੀ ਹੈ ਜਾਂ ਦਾਲ ਬਣੀ ਹੋਈ ਹੈ ਤਾਂ ਓਹਦੇ ਵਿੱਚ ਫਿੱਕੇ ਚੌਲ ਵੀ ਬਣਾ ਲਏ ਜਾਂਦੇ ਹਨ ਪਰੰਤੂ ਜੇਕਰ ਸਬਜ਼ੀ ਨਾ ਬਣੀ ਹੋਵੇ ਤਾਂ ਫਿਰ ਮੈਂ ਮਿੱਠੇ ਚੌਲ ਜਾਂ ਨਮਕੀਨ ਚੌਲ ਬਣਾਉਣਾ ਜ਼ਿਆਦਾ ਪਸੰਦ ਕਰਦੀ ਹਾਂ ਚੌਲਾਂ ਦੇ ਵਿੱਚ ਇਹ ਹੁੰਦਾ ਕਾਫੀ ਤਰ੍ਹਾਂ ਨਾਲ ਪੌਸ਼ ਇੱਕ ਪੌਸ਼ਟਿਕ ਆਹਾਰ ਵੀ ਮੰਨਿਆਂ ਜਾਂਦਾ ਹੈ ਸੋ ਇਸ ਕਰਕੇ ਮੈਨੂੰ ਚੌਲ ਬਣਾਉਣਾ ਘੱਟ ਸਮੇਂ ਦੇ ਵਿੱਚ ਬਹੁਤ ਫਾਇਦੇਮੰਦ ਲੱਗਦਾ ਹੈ